ਹੈਲੋ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਮੋਹਾਲੀ ਤੋਂ ਬੋਲ ਰਹੇ ਹੋ ਮੈਮ ਫੂਡ ਵਲੌਗਰ ਹਾਂ ਫੂਡ ਵਲੌਗਰ ਉਹ ਹੁੰਦੀ ਹੈ ਜਿਵੇਂ ਅਸੀਂ ਵਾ ਵੱਖ ਵੱਖ ਥਾਵਾਂ ਤੇ ਜਾਂਦੇ ਹੈ ਉੱਥੇ ਦੀ ਜੋ ਫ਼ੇਮਸ ਚੀਜ਼ ਹੁੰਦੀ ਹੈ ਮਠਿਆਈ ਹੁੰਦੀ ਹੈ ਕੋਈ ਖਾਣ ਦੀ ਚੀਜ਼ ਹੁੰਦੀ ਹੈ ਉਹਨੂੰ ਟੇਸਟ ਕਰਦੇ ਹੈ ਅਤੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਤਾਂ ਅਸੀਂ ਉਹਦੇ ਪੋਜ਼ਿਟਿਵ ਵਿਊਜ਼ ਵੀ ਦਿੰਦੇ ਹੈ ਹਾਂਜੀ ਤੇ ਮੈਮ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੁੰਦੀ ਸੀ ਕੀ ਤੁਹਾਡੇ ਇਲਾਕੇ ਵਿੱਚ ਕੋਈ ਫ਼ੇਮਸ ਕੋਈ ਸਵੀਟ ਸ਼ਾਪ ਹੈ ਅਤੇ ਮੈਮ ਮੈਂ ਇੱਥੇ ਕਯਾ ਫ਼ੇਮਸ ਮਿਲਦਾ ਏ ਜਿਹਨੂੰ ਖਾ ਕੇ ਮੈਂ ਵਧੀਆ ਵਧੀਆ ਰੀਵਿਊ ਦੇ ਸਕਾਂ ਠੀਕ ਹੈ ਮੈਮ ਮੈਮ ਮੇਰਾ ਨਾ ਕਰਮ ਮਾਨ ਦੇ ਨਾਮ 'ਤੇ ਯੂਟਿਊਬ 'ਤੇ ਚੈਨਲ਼ ਹੈ ਉੱਥੇ ਮਤਲਬ ਅਸੀਂ ਜਿੰਨੇ ਵੀ ਵਲੌਗ ਬਣਾਉਂਦੇ ਹਾਂ ਉੱਥੇ ਅੱਪਲੋਡ ਵੀ ਕਰਦੇ ਹੈ ਅਤੇ ਜਿਹੜੀ ਵਧੀਆ ਸਾਨੂੰ ਲੱਗਦਾ ਅਤੇ ਉਹਨੂੰ ਪ੍ਰਮੋਟ ਵੀ ਕਰਦੇ ਹੈ ਤੁਸੀਂ ਸਾਨੂੰ ਫੋਲੋ ਵੀ ਕਰਿਓ ਸਸਕ੍ਰਾਇਬ ਵੀ ਕਰਿਓ ਠੀਕ ਹੈ ਜੀ ਮੈਮ ਬਹੁਤ ਹਾਂਜੀ ਹਾਂਜੀ ਜ਼ਰੂਰ ਬਹੁਤ ਧੰਨਵਾਦ ਤੁਹਾਡਾ ਸਾਨੂੰ ਇੰਨੀ ਕੀਮਤੀ ਸਮੇਂ ਵਿੱਚੋਂ ਆਪਣਾ ਟਾਇਮ ਦੇਣ ਲਈ ਠੀਕ ਹੈ ਜੀ ਧੰਨਵਾਦ